ਹਾਂਜੀ ਕੀ ਤੁਸੀਂ ਪੰਜਾਬ ਵਿੱਚ ਚੋਣਾਂ ਕਰਵਾਉਣ ਅਤੇ ਸਿਆਸੀ ਨੇਤਾਵਾਂ ਦੀ ਚੋਣ ਕਰਨ 'ਚ ਪ੍ਰਕਿਰਿਆ ਦੀ ਵੀਕ ਵਿਆਖਿਆ ਕਰ ਸਕਦੇ ਹੋ ਪੰਜਾਬ ਵਿੱਚ ਆ ਪਿੱਛੇ ਹੀ ਐਮਐਲਏ ਦੇ ਚੋਣਾਂ ਹੋ ਕੇ ਹਟੀਆਂ ਹਨ ਜਿਹਦੇ ਵਿੱਚ ਮੈਂ ਕਹਿੰਦੀ ਆਂ ਇੰਨਾਂ ਖਰਚਾ ਕੀਤਾ ਗਿਆ ਇੰਨਾਂ ਜ਼ਿਆਦਾ ਹਰ ਇੱਕ ਹਰ ਇਕ ਨੇਤਾ ਨੇ ਜਿਹਨੇ ਜਿਹੜਾ ਵੀ ਚੋਣਾਂ ਲਈ ਖੜ੍ਹਾ ਹੋਇਆ ਸੀ ਉਹਨੇ ਇੰਨਾਂ ਜ਼ਿਆਦਾ ਖਰਚਾ ਕੀਤਾ ਇੰਨਾਂ ਜ਼ਿਆਦਾ ਇੰਨਾਂ ਇਸ਼ਤਿਆਰਬਾਜੀ ਕੀਤੀ ਇੰਨਾਂ ਜ਼ਿਆਦਾ ਖਰਚਾ ਕੀਤਾ ਕਿ ਮਤਲਬ ਮੈਨੂੰ ਲੱਗਦਾ ਹੈ ਕਰੋੜਾਂ ਰੁਪਈਆ ਇਹਨਾਂ ਨੇ ਇਸ ਤਰ੍ਹਾਂ ਹੀ ਖਰਚ ਦਿੱਤੇ ਹਨ ਜਦ ਕਿ ਇਹ ਪਤਾ ਨਹੀਂ ਹੁੰਦਾ ਕਿ ਕਿਹਨੇ ਜਿੱਤਣਾ ਕਿਹਨੇ ਨਹੀਂ ਜਿੱਤਣਾ ਪਰ ਆਪਣੇ ਵੱਲੋਂ ਹਰ ਕਿਸੇ ਨੇ ਇੰਨਾਂ ਜ਼ਿਆਦਾ ਖਰਚਾ ਕੀਤਾ ਕਿ ਉਹੀ ਖਰਚਾ ਜਿਹੜਾ ਤੁਸੀਂ ਇੱਦਾਂ ਖਰਚ ਕਰ ਰਹੇ ਹੋ ਚੋਣਾਂ 'ਤੇ ਇੰਨੀ ਜ਼ਿਆਦਾ ਇੰਨੀ ਪੈਸੇ ਦੀ ਬਰਬਾਦੀ ਕਰ ਰਹੇ ਹੋ ਉਹੀ ਤੁਸੀਂ ਕਿਸੀ ਅੱਛੀ ਜਗ੍ਹਾ 'ਤੇ ਲਗਾ ਦਿਓ ਕਿਸੇ ਕਿਸੇ ਦਾ ਭਲਾ ਕਰ ਦਿਓ ਤੁਸੀਂ ਔਰ ਇਸ ਤੋਂ ਇਲਾਵਾ ਜਿਹੜੇ ਆ ਸਿਆਸੀ ਨੇਤਾ ਇਹਨਾਂ ਦੀਆਂ ਚੋਣਾਂ ਇਹਨਾਂ ਦੀ ਚੋਣ ਕਰਨ ਵਿੱਚ ਵੀ ਇੰਨੀ ਦਿੱਕਤ ਆਉਂਦੀ ਹੈ ਹੁਣ ਇਹ ਨਹੀਂ ਪਤਾ ਕਿ ਦਿਲ ਵਿੱਚ ਇਹਨਾਂ ਦੇ ਕੀ ਹੈ ਅਤੇ ਮੂੰਹ 'ਤੇ ਕੀ ਆ ਕਿਉਂਕਿ ਮੂੰਹ 'ਤੇ ਤਾਂ ਸਾਰੇ ਹੀ ਚੰਗੇ ਹੁੰਦੇ ਹਨ ਹੁਣ ਇਹ ਤਾਂ ਜਦੋਂ ਇਹ ਨੇਤਾ ਬਣ ਜਾਂਦੇ ਹਨ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹਨਾਂ ਨੇ ਕੀ ਫਾਇਦਾ ਕੀਤਾ ਅਤੇ ਕੀ ਨਹੀਂ ਬਾਅਦ ਵਿੱਚ ਪਤਾ ਲੱਗਦਾ ਤੋ ਇਸ ਤੋਂ ਇਲਾਵਾ ਕੋਈ ਵੀ ਅੱਜ ਦੇ ਟਾਈਮ ਵਿੱਚ ਕੋਈ ਵੀ ਨੇਤਾ ਸਭ ਤੋਂ ਪਹਿਲਾਂ ਆਪਣੀ ਜੇਬਾਂ ਭਰਨ ਵੱਲ ਧਿਆਨ ਰੱਖਦਾ ਹੈ ਆਮ ਲੋਕਾਂ ਦੀ ਸਹਾਇਤਾ ਤਾਂ ਉਹ ਕਰਦੇ ਹੀ ਨਹੀਂ ਹਨ ਦਿਖਾਉਂਦੇ ਇਹੀ ਹੈ ਪਹਿਲਾਂ ਇਹੀ ਕਹਿੰਦੇ ਹੁੰਦੇ ਕਿ ਸਾਨੂੰ ਤੁਸੀਂ ਵੋਟ ਪਾਓ ਅਤੇ ਅਸੀਂ ਤੁਹਾਡੇ ਆਹ ਸੁਧਾਰਾਂਗੇ ਆਸ ਕੰਮ ਕਰਾਂਗੇ ਉਹ ਕੰਮ ਕਰਾਂਗੇ ਉਸ ਤੋਂ ਬਾਅਦ ਜਦੋਂ ਬਣ ਜਾਂਦੇ ਹਨ ਉਸ ਤੋਂ ਬਾਅਦ ਇਹ ਪੁੱਛਦੇ ਵੀ ਨਹੀਂ ਹਨ